ਗਿਆਰਾਂ ਹਜ਼ਾਰ ਪੰਜ ਸੌ ਦੋ ਪੰਜ ਹਜ਼ਾਰ ਪੰਜ ਸੌ ਵੀਹ ਤਿੰਨ ਲੱਖ ਪਚਾਨਵੇਂ ਹਜ਼ਾਰ ਪੰਜ ਲੱਖ ਵੀਹ ਹਜ਼ਾਰ ਚੌਦਾਂ ਹਜ਼ਾਰ ਸੱਤ ਸੌ ਵੀਹ